ਹੈਲੋ ਹੈਲੋ ਹੈਲੋ ਹਾਂਜੀ ਬਸ ਬਸ ਸਟੈਂਡ ਤੋਂ ਬੋਲ ਰਹੇ ਹੋ ਤੁਸੀਂ ਮੈਡਮ ਮੈਂ ਟਿਕਟ ਬੁੱਕ ਕਰਵਾਉਣੀ ਸੀ ਫਾਜਿਲਕਾ ਟੂ ਫਾਜਿਲਕਾ ਤੋਂ ਅੰਮ੍ਰਿਤਸਰ ਦੀ ਤੇ ਉਹ ਵੀ ਸਲਿੱਪਰ ਕਰਾਣੀ ਐ ਮੈਂ ਹਾਂਜੀ ਹਾਂਜੀ ਮੈਮ ਤੁਸੀਂ ਮੈਨੂੰ ਅਲਗ ਅਲਗ ਰੇਟ ਦੱਸ ਦੋ ਸੀਟ ਬੁਕਿੰਗ ਦੇ ਰਾਤ ਦੀ ਮੈਮ

ਅੱਛਾ ਅੱਛਾ ਮੈਮ ਅੱਛਾ ਮੈਮ ਅੱਛਾ ਮੈਮ ਤੇ ਕਿੰਨਾ ਟਾਈਮ ਲੱਗ ਜਾਊਗਾ ਮੈਮ ਇਸ ਟਾਈਮ ਤੇ ਇੱਕ ਹੀ ਕਰਵਾਣੀ ਐ ਹਾਂਜੀ ਤੇ ਉਹ ਅੱਛਾ ਜੀ ਅੱਛਾ ਮੈਮ ਤੇ ਹੋਰ ਇਹਦੇ ਵਿੱਚ ਕੀ ਕੀ ਸੂਵਿਧਾ ਮਿਲੂਗੀ ਬਸ ਚ ਅੱਛਾ ਮੈਮ ਅੱਛਾ ਮੈਮ ਠੀਕ ਐ ਮੈਮ ਤੇ ਹੁਣ ਉਹ ਜਿਵੇਂ ਹੀਟਰ ਵਗੈਰਾ ਹੋ ਸਕਦੀ ਐ ਚੱਲ ਰਹੀ ਐ ਤੇ ਹੀਟਰ ਵਗੈਰਾ ਕੁਛ ਉਹ ਅੱਛਾ ਮੈਮ ਅੱਛਾ ਹਾਂਜੀ ਮੈਮ ਤੇ ਹੁਣ ਮੇਰੀ ਟਿਕਟ ਜਿਹੜੀ ਐ ਉਹ ਕਿਹੜੀ ਟਰੈਵਲ ਵਿੱਚ ਤੁਸੀਂ ਕਰ ਰਹੇ ਹੋ ਅੱਛਾ ਅੱਛਾ ਮੈਮ ਉਂਜ ਨਹੀਂ ਜਾ ਸਕਦੀ ਵਿਨੋਦ ਵਾਲੇ ਦੀ ਕੋਈ ਹੋਰ ਨਹੀਂ ਜਾਂਦੀ ਅੱਛਾ ਤੇ ਉਹਦਾ ਉਹਦਾ ਕੀ ਰੇਟ ਹੈਗਾ ਅੱਛਾ ਅੱਛਾ ਮੈਮ ਠੀਕ ਐ ਤੇ ਉਹਦੇ ਵਿੱਚ ਵੀ ਸੁਵਿਧਾ ਆਈ ਏਹ ਜਾਂ ਫਿਰ ਕੁਝ ਹੋਰ ਜਿਆਦਾ ਕਿਉਂ ਦਾ ਰੇਟ ਜਿਆਦਾ ਹੈਗਾ ਅੱਛਾ ਮੈਮ ਹਾਂਜੀ ਮੈਮ ਅੱਛਾ ਮੈਮ ਤੇ ਉਹਨੇ ਵਿੱਚ ਵੀ ਸੇਮ ਹੀ ਟਾਈਮ ਲੱਗਣਾ ਜਾਣ ਲੱਗਿਆ ਅੱਛਾ ਮੈਮ ਠੀਕ ਐ ਮੈਮ ਫਿਰ ਤੁਸੀਂ ਇੱਕ ਟਿਕਟ ਬੁੱਕ ਕਰ ਦੋ ਮੇਰੀ ਅੱਛਾ ਮੈਮ ਠੀਕ ਠੀਕ ਹੈ ਮੈਮ ਉਹ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਦਾਂਗੇ ਜਿਵੇਂ ਤੁਹਾਨੂੰ ਸਹੀ ਲੱਗੇ ਹਾਂਜੀ ਮੈਂ ਜੇ ਆਨਲਾਈਨ ਕਰਾਉਣਾ ਤੁਸੀਂ ਆਨਲਾਈਨ ਕਰਵਾ ਸਕਦੇ ਠੀਕ ਐ ਥੈਂਕ ਯੂ